ਅੱਠ ਸਤੰਬਰ ਉੱਨੀ ਸੌ ਅਠਾਸੀ ਨੌ ਜਨਵਰੀ ਦੋ ਹਜ਼ਾਰ ਤੇਈ ਪੰਜ ਸਤੰਬਰ ਉੱਨੀ ਸੌ ਅਠਾਸੀ ਤਿੰਨ ਫਰਵਰੀ ਦੋ ਹਜ਼ਾਰ ਚੌਵੀ ਪੰਜ ਨਵੰਬਰ ਉੱਨੀ ਸੌ ਪੱਚ ਛਿਆਸੀ